ਇਹ ਜੋ ਪੰਜਾਬੀ ਭਾਸ਼ਾ ਹੈ ਇਹ ਸਾਡੇ ਜੋ ਗੁਰੂ ਹੈ ਤੀਜੇ ਦੂਜੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾ ਦੇ ਮੁਖ ਵਿੱਚੋਂ ਹੀ ਪੰਜਾਬੀ ਭਾਸ਼ਾ ਆਈ ਸੀ ਜਿਸ ਨੂੰ ਅਸੀਂ ਗੁਰਮੁਖੀ ਭਾਸ਼ਾ ਵੀ ਕਹਿੰਦੇ ਹਾਂ ਪੰਜਾਬੀ ਭਾਸ਼ਾ ਜਿਵੇਂ ਕਿ ਤੁਸੀਂ ਲਿਖਿਆ ਹੋਇਆ ਕਿ ਸਾਹਿਤ ਕਵਿਤਾ ਹੈ ਨਾ ਤਾਂ ਹੋਰ ਬੜਾ ਲਿਟਰੇਚਰ ਵੀ ਜੋ ਹੈ ਪੰਜਾਬੀ 'ਚ ਲਿਖਿਆ ਹੋਇਆ ਕਹਾਣੀਆਂ ਹੈ ਨਾਵਲ ਸਨ ਨਾਟਕ ਹਨ ਤਾਂ ਉਸ ਤੋਂ ਇਲਾਵਾ ਪੰਜਾਬੀ ਨੂੰ ਪੰਜਾਬੀ ਭਾਸ਼ਾ ਦੀ ਜੋ ਵਰਤੋਂ ਹੈ ਸਿਨੇਮਾ ਦੇ ਵਿੱਚ ਵੀ ਹੈ ਥਿਏਟਰ ਦੇ ਵਿੱਚ ਵੀ ਹੈ ਜਿਵੇਂ ਕਿ ਅੱਜ ਕੱਲ੍ਹ ਪੰਜਾਬੀ ਫਿਲਮਾਂ ਦਾ ਦੌਰ ਅੱਜ ਕੀ ਬੜਾ ਪੁਰਾਣਾ ਦੌਰ ਹੈ ਪੰਜਾਬੀ ਫਿਲਮਾਂ ਦਾ ਅਤੇ ਪੰਜਾਬੀ ਭਾਸ਼ਾ ਦਾ ਜ਼ਿਦਗੀ ਵਿੱਚ ਬੜੀ ਵਰਤੋ ਕੀਤੀ ਜਾਂਦੀ ਹੈ ਤਾਂ ਪੰਜਾਬੀ ਭਾਸ਼ਾ ਦਫਤਰਾਂ ਦੇ ਵਿੱਚ ਵੀ ਬੜੀ ਜਿਵੇਂ ਪੰਜਾਬ ਜੋ ਸਟੇਟ ਹੈ ਉਸ ਵਿੱਚ ਇਹ ਪਹਿਲੀ ਭਾਸ਼ਾ ਅਤੇ ਬੜੀ ਲਾਜ਼ਮੀ ਭਾਸ਼ਾ ਅਤੇ ਜੋ ਪੰਜਾਬੀ ਵੈਸੇ ਵੀ ਜਿਹੜੀ ਹੋਰ ਭਾਸ਼ਾਵਾਂ ਨਾਲੋਂ ਬੜੀ ਉੱਤਮ ਭਾਸ਼ਾ ਜੋ ਮੰਨੀ ਜਾਂਦੀ ਹੈ ਤਾਂ ਇੰਡੀਆ ਦੇ ਵਿੱਚ ਇਸਦਾ ਦਰਜਾ ਤੀਜਾ ਪੰਜਾਬੀ ਭਾਸ਼ਾ ਦਾ ਇਹ ਪੰਜਾਬ ਦੀ ਮਾਂ ਬੋਲੀ ਹੈ ਪੰਜਾਬੀ ਭਾਸ਼ਾ ਦਫਤਰਾਂ ਦੇ ਵਿੱਚ ਵਰਤੀ ਜਾਂਦੀ ਹੈ ਉਸ ਤੋਂ ਬਾਅਦ ਕਨੇਡਾ ਦੇ ਵਿੱਚ ਇਸ ਪੰਜਾਬੀ ਭਾਸ਼ਾ ਨੂੰ ਦੂਸਰਾ ਦਰਜਾ ਦਿੱਤਾ ਗਿਆ ਇੰਗਲੈਂਡ ਦੇ ਵਿੱਚ ਵੀ ਇਸ ਭਾਸ਼ਾ ਨੂੰ ਦੂਸਰਾ ਦਰਜਾ ਦਿੱਤਾ ਗਿਆ ਪਰ ਪੰਜਾਬੀ ਭਾਸ਼ਾ ਇੱਕ ਬੜੀ ਹੀ ਗੁਰੂਆਂ ਪੀਰਾਂ ਤੋਂ ਸਾਨੂੰ ਜਿਹੜੀ ਇਹ ਪੰਜਾਬੀ ਭਾਸ਼ਾ ਮਿਲੀ ਹੈ ਤਾਂ ਇਸ ਦੀ ਵਰਤੋਂ ਜਿਵੇਂ ਪਹਿਲਾਂ ਜੋ ਲੋਕ ਹੁੰਦੇ ਸੀ ਚਿੱਠੀਆਂ ਪੱਤਰਾਂ ਰਾਹੀਂ ਜੋ ਪਰਿਵਾਰ ਰਿਸ਼ਤੇਦਾਰ ਚਿੱਠੀਆਂ ਪੱਤਰਾਂ ਰਾਹੀਂ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਸੀ ਫਿਲਮਾਂ ਦੇ ਵਿੱਚ ਵੀ ਹੋਣ ਲੱਗ ਗਈ ਉਸ ਤੋਂ ਬਾਅਦ ਵੀ ਹਿੰਦੀ ਜੋ ਫਿਲਮ ਇੰਡਸਟਰੀ ਬੋਲੀਵੁੱਡ ਇੰਡਸਟਰੀ ਆ ਉਸ ਦੇ ਵਿੱਚ ਵੀ ਪੰਜਾਬੀ ਭਾਸ਼ਾ ਦੀ ਜੋ ਵਰਤੋਂ ਕੀਤੀ ਜਾਂਦੀ ਹੈ ਅਤੇ ਹੋਰ ਵੀ ਉਸ ਤੋਂ ਬਾਅਦ ਜਿਵੇਂ ਮੇਲਿਆਂ ਦੇ ਵਿੱਚ ਤਿਉਹਾਰਾਂ ਦੇ ਵਿੱਚ ਪੰਜਾਬੀ ਭਾਸ਼ਾ ਦਾ ਜਾਂ ਬੜਾ ਯੋਗਦਾਨ ਹੈ ਪੰਜਾਬੀ ਕਲਾਕਾਰਾਂ ਦਾ ਬੜਾ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਬੜਾ ਯੋਗਦਾਨ ਹੈ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਜੋ ਆਪਣੇ ਗਾਣੇ ਲਿਖੇ ਵੀ ਹੈ ਪੰਜਾਬੀ ਭਾਸ਼ਾ ਦੇ ਵਿੱਚ ਗਾਣੇ ਜੋ ਗਾਏ ਵੀ ਹੈ ਤਾਂ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਇਕੱਲੇ ਪੰਜਾਬ 'ਚ ਨਹੀਂ ਹੈ ਇਕੱਲੇ ਹਿੰਦੁਸਤਾਨ ਦੇ ਵਿੱਚ ਨਹੀਂ ਹੈ ਭਾਰਤ ਵਿੱਚ ਨਹੀਂ ਹੈ ਬਲਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਕੈਨੇਡਾ ਲਾ ਲਾਓ ਅਮੈਰੀਕਾ ਲਾ ਲਓ ਇੰਗਲੈਂਡ ਲਾ ਲਓ ਨਿਊਜ਼ੀਲੈਂਡ ਔਸਟ੍ਰੇਲੀਆ ਪਾਕਿਸਤਾਨ ਹਰ ਇੱਕ ਦੇਸ਼ ਦੇ ਵਿੱਚ ਜੋ ਪੰਜਾਬੀ ਵੱਸਦੇ ਨੇ ਜੋ ਪੰਜਾਬੀ ਭਾਸ਼ਾ ਦੇ ਵਿੱਚ ਉਹ ਲੋਕਾਂ ਨਾਲ ਗੱਲਬਾਤ ਕਰਦੇ ਨੇ ਆਪਣੇ ਵਿਚਾਰ ਵਟਾਂਦਰੇ ਜੋ ਸ਼ੇਅਰ ਕਰਦੇ ਨੇ ਤਾਂ ਇਹ ਪੰਜਾਬੀ ਭਾਸ਼ਾ ਵੈਸੇ ਵੀ ਇੱਕ ਜੋ ਐਨਸੀਅੰਟ ਭਾਸ਼ਾ ਬੜੀ ਅੱਛੀ ਭਾਸ਼ਾ ਦੇ ਬੋਲਣ ਵਿੱਚ ਬੜਾ ਮੈਂ ਮਾਣ ਮਹਿਸੂਸ ਹੁੰਦਾ ਅਤੇ ਇਸ ਵਿੱਚ ਗੱਲ ਕਰਨ ਨਾਲ ਸਾਨੂੰ ਅਲੱਗ ਤੋਂ ਇੱਕ ਰੁਤਬਾ ਵੀ ਮਿਲਦਾ ਜੋ ਸਾਨੂੰ ਪੰਜਾਬੀ ਭਾਸ਼ਾ ਨੇ ਦਿੱਤਾ ਤਾਂ ਪੰਜਾਬੀ ਭਾਸ਼ਾ ਬਾਰੇ ਜਿੰਨਾ ਵੀ ਮੈਂ ਬੋਲਾਂਗਾ ਸ਼ਾਇਦ ਮੈਨੂੰ ਮੈਂ ਨਹੀਂ ਬੋਲ ਪਾਵਾਂਗਾ ਇਸ ਬਾਰੇ ਪਰ ਪੰਜਾਬੀ ਭਾਸ਼ਾ ਇੱਕ ਬੜੀ ਉੱਤਮ ਭਾਸ਼ਾ ਪੰਜਾਬ ਦੀ ਪੰਜਾਬੀਆਂ ਲਈ ਸੋ ਸਕੂਲਾਂ ਦੇ ਵਿੱਚ ਵੀ ਜੋ ਪੰਜਾਬੀ ਮੀਡੀਅਮ ਨੂੰ ਛੱਡ ਕੇ ਲੋਕ ਹਿੰਦੀ ਮੀਡੀਅਮ ਜਾਂ ਇੰਗਲਿਸ਼ ਮੀਡੀਅਮ ਨੂੰ ਪ੍ਰੈਫਰ ਕਰਦੇ ਆ ਮੈਂ ਉੱਥੇ ਵੀ ਚਲੋ ਕਹਾਂਗਾ ਵੀ ਚਲੋ ਕੋਈ ਗੱਲ ਨਹੀਂ ਜੋ ਉਹਨਾਂ ਦਾ ਮੀਡੀਅਮ ਹੈ ਠੀਕ ਹੈ ਪੰਜਾਬੀ ਭਾਸ਼ਾ ਦਾ ਲੇਕਿਨ ਪੰਜਾਬੀ ਵੀ ਲਾਜ਼ਮੀ ਪੜ੍ਹੋ ਹੈ ਨਾ ਧੰਨਵਾਦ